ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਸੈਣੀ ਕਲੋਥ ਹਾਊਸ ਤੋਂ ਬੋਲ ਰਹੇ ਮੈਮ ਮੈਂ ਇੱਥੇ ਪੰਜਾਬ ਵਿੱਚ ਨਿਊ ਆਈ ਸੀ ਅਤੇ ਮੈਨੂੰ ਮਤਲਬ ਕਿ ਮੈਰਿਜ ਲਈ ਡਰੈੱਸਾਂ ਚਾਹੀਦੀਆਂ ਸੀਗੀਆਂ ਹਾਂਜੀ ਮੈਮ ਮੈਮ ਤੁਸੀਂ ਮੈਨੂੰ ਦੱਸ ਸਕਦੇ ਇੱਥੇ ਪੰਜਾਬੀ ਸੱਭਿਆਚਾਰਾਂ ਦੀ ਡਰੈੱਸ ਕਿੱਦਾਂ ਦੀ ਹੈਗੀ ਏ ਤੁਸੀਂ ਮੈਨੂੰ ਦੱਸ ਸਕਦੇ ਹੋ ਥੋੜ੍ਹਾ ਹਾਂਜੀ ਮੈਮ ਮੈਮ ਤੁਸੀਂ ਮੈਨੂੰ ਮਤਲਬ ਫੁਲਕਾਰੀ ਕਿੱਦਾਂ ਦੀ ਹੁੰਦੀ ਹੈ ਮੈਮ ਹਾਂਜੀ ਮੈਮ ਹਾਂਜੀ ਮੈਮ ਅੱਛਾ ਮੈਮ 'ਤੇ ਮੈਮ ਜਿਵੇਂ ਸ਼ਰਾਰਾ ਅਤੇ ਗਰਾਰਾ ਇਹ ਕਿਵੇਂ ਦੇ ਹੈ ਤੁਹਾਡੇ ਕੋਲ ਹਾਂਜੀ ਮੈਮ ਮੈਮ ਮੈਨੂੰ ਮਤਲਬ ਕਿ ਜਾਗੋ 'ਚ ਪਾਉਣਾ ਤਾਂ ਥੋੜ੍ਹਾ ਵਧੀਆ ਅਤੇ ਟਰੈਂਡ ਸੋਹਣਾ ਲੱਗੇ ਪਾਉਣ ਨੂੰ ਹਾਂਜੀ ਹਾਂਜੀ ਪੁਰਾਣੇ ਹਾਂਜੀ ਹਾਂਜੀ ਮੈਮ ਮੈਮ ਇੰਨਾਂ ਦੇ ਪ੍ਰਾਈਜ਼ ਵਗੈਰਾ ਕਿੱਦਾਂ ਏ ਮੈਮ ਸ਼ਰਾਰੇ ਦਾ ਵੀ ਗਰਾਰੇ ਦਾ ਅਤੇ ਫੁਲਕਾਰੀ ਦਾ ਤੁਸੀਂ ਮੈਨੂੰ ਸਾਰਿਆਂ ਦੇ ਰੇਟ ਦੱਸ ਦਿਉ ਮੈਮ ਅੱਛਾ ਮੈਮ ਹਾਂਜੀ ਮੈਮ ਅੱਛਾ ਮੈਮ ਅਤੇ ਮੈਮ ਫੁਲਕਾਰੀ ਮੈਮ ਜੇ ਮੈਂ ਇਹ ਤਿੰਨੇ ਚੀਜ਼ਾਂ ਲਵਾਂ ਤਾਂ ਮੈਨੂੰ ਕਿਆ ਡਿਸਕਾਉਂਟ ਡਿਸਕਾਉਂਟ ਮਿਲ ਜੂਗਾ ਹਮ ਹਮ ਚਲੋ ਠੀਕ ਹੈ ਮੈਮ ਤੁਸੀਂ ਮੈਨੂੰ ਨਾ ਪਿਕ ਸੈਂਡ ਕਰ ਦਿਓ ਫਿਰ ਮੈਂ ਤੁਹਾਨੂੰ ਨਾ ਫੋਟੋਆਂ ਦੇਖ ਕੇ ਬੈਕ ਕੋਲ ਕਰਦੀ ਹਾਂ ਓਕੇ ਮੈਮ ਸਤਿ ਸ਼੍ਰੀ ਅਕਾਲ ਮੈਮ ਓਕੇ ਜੀ